ਪੇਂਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਕੰਮ ਲਈ ਤਿਆਰ ਕਰਨਾ ਚਾਹੀਦਾ ਹੈ ਅਤੇ ਫਿਰ ਪੇਂਟਿੰਗ ਕਰਦੇ ਸਮੇਂ ਪੂਰਾ ਧਿਆਨ ਆਪਣੇ ਕੰਮ 'ਤੇ ਦੇਣਾ ਚਾਹੀਦਾ ਹੈ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਉਸ ਕੰਮ ਨੂੰ ਸਿਰੇ ਚਾੜ੍ਹਨਾ ਚਾਹੀਦਾ ਹੈ ਜਿਹੜਾ ਕੰਮ ਪੂਰੀ ਮਿਹਨਤ ਅਤੇ ਲਗਨ ਕੀਤਾ ਹੋਊਗਾ ਉਸ ਦਾ ਰਿਜ਼ਲਟ ਵੀ ਚੰਗਾ ਆਉਂਦਾ ਹੈ ਅਤੇ ਪੇਂਟਿੰਗ ਕਰਦੇ ਸਮੇਂ ਪੂਰਾ ਧਿਆਨ ਆਪਣੀ ਪੇਂਟਿੰਗ 'ਤੇ ਦੇਣਾ ਚਾਹੀਦਾ ਹੈ